ਮੈਂ ਸੰਪਾਦਨ ਅਤੇ ਸੰਸ਼ੋਧਨਾਂ ਦੇ ਲਈ ਇੱਕ ਵਿਸ਼ੇਸ਼ ਪ੍ਰਕਿਰਿਆ ਅਪਣਾਉਂਦੀ ਹਾਂ ਸਭ ਤੋਂ ਪਹਿਲਾਂ ਮੈਂ ਆਪਣੇ ਲਿਖੇ ਕੰਮ ਨੂੰ ਕੁਝ ਸਮੇਂ ਲਈ ਛੱਡ ਦਿੰਦੀ ਹਾਂ ਤਾਂਕਿ ਮੈਂ ਉਹਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਵੇਖ ਸਕਾਂ ਫਿਰ ਮੈਂ ਇਸਨੂੰ ਧਿਆਨ ਨਾਲ ਪੜ੍ਹਦੀ ਹਾਂ ਅਤੇ ਆਪਣੀਆਂ ਗਲਤੀਆਂ ਜਾਂ ਸੰਭਾਵਿਤ ਸੁਧਾਰਾਂ ਨੂੰ ਲੱਭਦੀ ਹਾਂ ਇਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਜਾਂ ਦੋਸਤਾਂ ਤੋਂ ਫੀਡਬੈਕ ਮੰਗਦੀ ਹਾਂ ਉਹਨਾਂ ਦਿਆਂ ਸੁਝਾਵਾਂ ਅਤੇ ਨਜ਼ਰੀਏ ਨੂੰ ਧਿਆਨ ਵਿੱਚ ਰੱਖ ਕੇ ਮੈਂ ਆਪਣੇ ਕੰਮ ਨੂੰ ਫਿਰ ਤੋਂ ਸੰਪਾਦਿਤ ਕਰਦੀ ਹਾਂ ਅੰਤ ਵਿਚ ਮੈਂ ਇੱਕ ਆਖਰੀ ਵਾਰ ਪੜ੍ਹਦੀ ਹਾਂ ਤਾਂ ਜੋ ਇਹ ਯਕੀਨੀ ਬਣਾ ਸਕਾਂ ਕਿ ਸਭ ਕੁਝ ਠੀਕ ਹੈ ਅਤੇ ਮੇਰੀ ਵਿਚਾਰਧਾਰਾ ਸਾਫ ਹੈ ਇਸ ਪ੍ਰਕਿਰਿਆ ਨਾਲ ਮੈਂ ਆਪਣੇ ਕੰਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹਾਂ